ਸਾਡੇ ਸੱਭਿਆਚਾਰਕ ਵਿੱਚ ਕੁੜੀਆਂ ਗਿੱਧੇ ਵਿੱਚ ਕੁੜੀਆਂ ਪੰਜਾਬੀ ਸੂਟ ਅਤੇ ਪੰਜਾਬੀ ਜੁੱਤੀ ਸਿਰ 'ਤੇ ਸੱਗੀ ਫੁੱਲ ਅਤੇ ਸਿਰ 'ਤੇ ਚੁੰਨੀਆਂ ਗੋਟੇ ਵਾਲੀਆਂ ਲੈ ਕੇ ਨੱਚਦੀਆਂ ਟੱਪਦੀਆਂ ਗਿੱਧੇ ਪਾਉਦੀਆਂ ਆਉਂਦੀਆ ਹਨ ਅਤੇ ਹੱਥ ਵਿੱਚ ਪੱਖੀਆਂ ਲੈ ਕੇ ਨੱਚਦੀਆਂ ਹਨ ਅਤੇ ਗਲਾਂ ਵਿੱਚ ਚੁੰਨੀਆਂ ਚਰਖ਼ੇ ਲੈ ਕੇ ਬਹਿ ਕੇ ਗਿੱਧੇ ਭੰਗੜੇ ਪਾਉਦੀਆਂ ਹਨ ਅਤੇ ਸਿਰ 'ਤੇ ਘੜੇ ਚੱਕ ਕੇ ਬਹੁਤ ਹੀ ਧੂੰਮਾਂ ਪਾਉਦੀਆਂ ਹਨ ਸਿਰ 'ਤੇ ਮੱਥੇ ਉੱਤੇ ਟਿੱਕਾ ਲਗਾ ਕੇ ਅਤੇ ਗਲ ਵਿੱਚ ਕੈਂਠਾ ਪਾ ਕੇ ਨੱਚਦੀਆਂ ਅਤੇ ਝੂੰਮਦੀਆਂ ਹਨ ਸਭ ਦੇ ਸਾਡੇ ਸੱਭਿਆਚਾਰ ਚਾਰ ਬਹੁਤ ਹੀ ਵਧੀਆ ਪ੍ਰਕਾਰ ਦਾ ਹੁੰਦਾ ਹੈ